ਸਤਿ ਸ਼੍ਰੀ ਅਕਾਲ ਜੀ ਮੈਂ ਭਾਵਿਕਾ ਜਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਤੁਹਾਡੀ ਕੈਬ ਏਜੰਸੀ ਤੋਂ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਮੈਂ ਅੰਮ੍ਰਿਤਸਰ ਜਾਣ ਲਈ ਕੀਤੀ ਸੀ ਕਿਉਂਕਿ ਮੇਰਾ ਅੰਮ੍ਰਿਤਸਰ ਵਿੱਚ ਇੱਕ ਪੇਪਰ ਹੈ ਅਤੇ ਇਹ ਮੇਰੇ ਲਈ ਬਹੁਤ ਜ਼ਰੂਰੀ ਹੈ ਪਰ ਹੁਣ ਉਹ ਕੈਬ ਦਾ ਡਰਾਈਵਰ ਬੋਲ ਰਿਹਾ ਹੈ ਕਿ ਉਹ ਲੇਟ ਹੋ ਜਾਵੇਗਾ ਜਿਸ ਵਜ੍ਹਾ ਨਾਲ ਮੈਂ ਪੇਪਰ ਦੇਣ ਲਈ ਸਮੇਂ ਸਿਰ ਨਹੀਂ ਪਹੁੰਚ ਸਕਾਂਗੀ ਇਸ ਲਈ ਮੈਂ ਇਹ ਕੈਬ ਦੀ ਬੁਕਿੰਗ ਨੂੰ ਰੱਦ ਕਰ ਰਹੀ ਹਾਂ ਧੰਨ ਧੰਨਵਾਦ